ਹੈਲੋ ਸਤਿ ਸ਼੍ਰੀ ਅਕਾਲ ਜੀ

ਹਾਂਜੀ ਠੀਕ ਐ ਜੀ

ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਠੀਕ ਐ ਜੀ ਹਾਂਜੀ ਹਾਂਜੀ ਹਾਂਜੀ ਬਣਵਾ ਦਾਂਗੇ ਜੀ ਤੁਸੀਂ ਦੱਸ ਦੇਣਾ ਡੱਬਿਆਂ ਦੇ ਵਿੱਚ ਕੀ ਚੀਜ਼ ਪੈਕ ਕਰਨੀ ਫਿਰ ਅਸੀਂ ਉਸ ਹਿਸਾਬ ਤੇ ਉਹ ਮਠਿਆਈ ਤੁਹਾਨੂੰ ਪੈਕ ਕਰ ਦਿਆਂਗੇ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਕੋਈ ਗੱਲ ਨਹੀਂ ਸਾਨੂੰ ਮੇਰੀ ਮਿਠਿਆਈ ਦਾ ਕੋਈ ਲਾਂਭਾ ਨਹੀਂ ਆਏਗਾ ਕਿਉਂਕਿ ਮੇਰੀ ਮਠਿਆਈ ਬਾਹਰ ਵੀ ਬਹੁਤ ਜਾ ਰਹੀ ਤੇ ਕਾਫੀ ਆਨਲਾਈਨ ਵੀ ਜਾ ਰਹੀ ਹ ਕੋਈ ਲਾਂਭਾ ਨਹੀਂ ਆ ਰਿਹਾ ਮੇਰੇ ਨਹੀਂ ਚਾਹੀਦਾ ਕਿਉਂਕਿ ਬਾਹਰ ਵੀ ਲੋਕੀ ਬਹੁਤ ਜਿਆਦਾ ਭੇਜਦੇ ਨੇ ਇਹਨਾਂ ਨੂੰ ਹਾਂਜੀ ਹਾਂਜੀ ਹਾਂਜੀ ਹਾਂਜੀ ਕੋਈ ਗੱਲ ਨਹੀਂ ਜੀ ਠੀਕ ਜਰੂਰ ਤੇ ਤੁਸੀਂ ਦੱਸ ਦੇਣਾ ਸਾਨੂੰ ਕਿਹੜੀ ਮਠਿਆਈ ਚਾਹੀਦੀ ਹ ਫਿਰ ਤੁਹਾਨੂੰ ਉਹੀ ਪੈਕਿੰਗ ਕਰ ਦਾਂਗੇ ਤਾਂ ਜਿੱਥੇ ਜਰੂਰ ਤੇ ਤਿਲ ਬੁੱਗਾ ਹੋਵੇ ਤੁਹਾਨੂੰ ਅਸੀਂ ਬਣਵਾ ਕੇ ਤਿਆਰ ਕਰਕੇ ਤੁਹਾਨੂੰ ਫੋਨ ਕਰ ਦਿਆਂਗੇ ਤੁਸੀਂ ਲੈ ਜਾਣਾ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਆ ਹਾਂਜੀ ਹਾਂਜੀ ਕੋਈ ਗੱਲ ਨੀ ਜਿਹੜਾ ਸਮਾਨ ਤੁਸੀਂ ਕਹੋਗੇ ਤੁਹਾਨੂੰ ਉਹੀ ਬਣਾ ਦਿਆਂਗੇ ਥਾਡੀ ਹਾਂਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਹਾਂਜੀ ਸਾਡੀ ਦੁਕਾਨ ਤੇ ਮਠਿਆਈ ਤਾਂ ਹਰੇਕ ਤਰ੍ਹਾਂ ਦੀ ਬਣਦੀ ਹੈ ਤੇ ਜਿਵੇਂ ਗੁਲਾਬ ਜਾਮਣ ਹੋ ਗਏ ਰਸਗੁੱਲੇ ਮੱਠੀਆ ਬਰਫੀ ਹੋ ਗਈ ਕਲਾਕੰਦ ਹੋ ਗਈ ਅਲੱਗ ਅਲੱਗ ਤਰ੍ਹਾਂ ਦੀਆਂ ਬਰਫੀਆਂ ਆਉਂਦੀਆਂ ਨੇ ਤੇ ਜਿੰਨੀ ਵੀ ਵਰਾਇਟੀ ਤਿਆਰ ਕਰਦੋ ਉੱਨੀ ਥੋੜੀ ਹੁੰਦੀ ਆ ਫਿਰ ਵੀ ਜੋ ਤੁਸੀਂ ਕਹੋਗੇ ਅਸੀਂ ਉਹ ਥਾਡੀ ਵਰਾਇਟੀ ਤਿਆਰ ਕਰ ਦੇਵਾਂਗੇ ਜਿਹੜੇ ਤੁਹਾਨੂੰ ਚਾਹੀਦੀ ਹੋਈ ਹਾਂਜੀ ਹਾਂਜੀ ਹਾਂਜੀ ਹਾਂਜੀ ਕੋਈ ਗੱਲ ਨਹੀਂ ਜੀ ਹਾਂਜੀ ਉਹ ਤਾਂ ਕੋਈ ਗੱਲ ਨਹੀਂ ਤੁਸੀਂ ਦੱਸ ਦੇਣਾ ਕਿਹੜੀ ਕਿਹੜੀ ਚੀਜ਼ ਵਿੱਚ ਤੁਸੀਂ ਬਣਵਾਣੀ ਕੈਟਰਿੰਗ ਤੇ ਤੇ ਤੁਹਾਨੂੰ ਉਹਦਾ ਸਾਰਾ ਹਿਸਾਬ ਕਰਕੇ ਤੇ ਤੁਹਾਨੂੰ ਫਿਰ ਅਸੀਂ ਦੱਸ ਦਿਆਂਗੇ ਵੀ ਇਨਾ ਤੁਹਾਡਾ ਖਰਚਾ ਆਏਗਾ ਹਾਂਜੀ ਹਾਂਜੀ ਹਾਂਜੀ ਕੋਈ ਗੱਲ ਨਹੀਂ ਜੀ ਹਾਂ ਕੋਈ ਗੱਲ ਨਹੀਂ ਸਾਨੂੰ ਅਸੀਂ ਪੂਰਾ ਪੈਕਜ ਦੱਸ ਦਿਆਂਗੇ ਤੇ ਕਿਉਂਕਿ ਮਠਿਆਈ ਸਾਰੇ ਲੈ ਰਹੇ ਹੋ ਤੇ ਕੋਈ ਗੱਲ ਨਹੀਂ ਆਪਾਂ ਤੁਹਾਨੂੰ ਜਿੰਨੀ ਵੀ ਰੈਤ ਹੋ ਸਕੀ ਉਹਨਾਂ ਤੁਹਾਨੂੰ ਡਿਸਕਾਊਂਟ ਕਰ ਦੇਵਾਂਗੀ ਤੇ ਜਿੰਨੀ ਵੀ ਤੁਸੀਂ ਮਠਿਆਈ ਕਹੋਗੇ ਉਨੀ ਤੁਹਾਨੂੰ ਤਿਆਰ ਵੀ ਕਰਕੇ ਦਿਆਂਗੇ ਪੂਰੇ ਟਾਈਮ ਤੇ ਕਰਕੇ ਦਿਆਂਗੇ ਤੇ ਕੈਟਰਿੰਗ ਦਾ ਵੀ ਤੁਹਾਨੂੰ ਦੱਸ ਦਿਆਂਗੇ ਵੀ ਆਪਣਾ ਕੁੱਲ ਸਾਰਾ ਖਰਚਾ ਕਿੰਨਾ ਆਏਗਾ ਕਿੰਨਾ ਨਹੀਂ ਆਏਗਾ ਤੇ ਉਸ ਹਿਸਾਬ ਤੇ ਤੁਹਾਨੂੰ ਦੱਸ ਦਿਆਂਗੇ ਫੋਨ ਕਰਕੇ ਵੀ ਕਿੰਨਾ ਖਰਚਾ ਆਉਂਦਾ ਸਾਡਾ ਹਾਂਜੀ ਕੋਈ ਗੱਲ ਨਹੀਂ ਆਪਣਆ ਸਾਰਾ ਹੀ ਵੈਸ਼ਨੂੰ ਈ ਆ ਕੰਮ ਆਪਾਂ ਕਦੇ ਦੂਸਰਾ ਕੰਮ ਨਹੀਂ ਕੀਤਾ ਤੇ ਹਾਂਜੀ ਬਾਕੀ ਤੁਹਾਨੂੰ ਤੁਹਾਡਾ ਸਮਾਨ ਸਾਰਾ ਜਿੰਨੀ ਤਰੀਕ ਨੂੰ ਤੁਸੀਂ ਕਹੋਗੇ ਉੱਨੀ ਤਾਰੀਕ ਨੂੰ ਰੈਡੀ ਕਰਕੇ ਤੁਹਾਨੂੰ ਤਿਆਰ ਕਰਕੇ ਸਾਰਾ ਦੇ ਦਾਂਗੇ ਵਗੈਰਾ ਵੀ ਤੇ ਥਾਡਾ ਸਾਰਾ ਲੋਹੜੀ ਦਾ ਸਾਰਾ ਤਿਆਰ ਸਾਡਾ ਪ੍ਰੋਗਰਾਮ ਕਰਕੇ ਦੇ ਦਾਂਗੇ ਥੋਨੂੰ ਹਾਂਜੀ ਠੀਕ ਹੈ ਜੀ ਓਕੇ